ਮੈਂ ਰਾਮਦਾਸ ਪਿੰਡ ਨਵਾਂ ਗਰਾਮ ਡਾਕਖਾਨਾ ਸੁਜਾਨਪੁਰ ਤਹਿਸੀਲ ਅਤੇ ਜ਼ਿਲ੍ਹਾ ਪਠਾਨਕੋਟ ਰਾਜ ਪੰਜਾਬ ਦਾ ਰਹਿਣ ਵਾਲਾ ਅਤੇ ਸਾਡਾ ਰਾਜ ਇੱਕ ਬੜਾ ਖੁਸ਼ਹਾਲ ਰਾਜ ਹੈ ਰਾਜ ਨਹੀਂ ਕਹਿ ਲਈਏ ਕਿ ਇਹ ਕਿਸੇ ਸਮੇਂ ਇੱਕ ਦੇਸ਼ ਹੁੰਦਾ ਸੀ ਅਤੇ ਇਹ ਬੜਾ ਹੀ ਖੁਸ਼ਹਾਲ ਦੇਸ਼ ਸੀ ਇਸ ਬਾਰੇ ਕਈ ਲੋਕ ਗੀਤ ਪ੍ਰਚਲਿਤ ਹਨ ਕਿ ਜਿਵੇਂ ਕਿ ਦੇਸ਼ਾਂ ਵਿੱਚੋਂ ਦੇਸ਼ ਪੰਜਾਬ ਨੀ ਸਈਓ ਇਸ ਤਰ੍ਹਾਂ ਦੇ ਹੋਰ ਵੀ ਕਈ ਲੋਕ ਗੀਤ ਜਿਹੜੇ ਪੰਜਾਬ ਦੇ ਬਾਰੇ ਪੰਜਾਬ ਦੇ ਸੱਭਿਆਚਾਰ ਬਾਰੇ ਪੰਜਾਬ ਦੀ ਵਿਰਾਸਤ ਬਾਰੇ ਦੱਸਦੇ ਹਨ ਅਤੇ ਸਾਡੇ ਪੰਜਾਬ ਰਾਜ ਦੀ ਵਿਰਾਸਤ ਸੱਭਿਆਚਾਰਕ ਵਿਰਾਸਤ ਬੜੀ ਅਮੀਰ ਹੈ ਅਤੇ ਇਸ ਦੇ ਸੱਭਿਆਚਾਰਕ ਵਿਰਾਸਤ ਨੂੰ ਸੰਭਾਲਣ ਵਾਸਤੇ

ਬੜਾ ਯੋਗਦਾਨ ਪਾਉਣ ਦੀ ਲੋੜ ਹੈ ਅਤੇ ਪਾਉਣਾ ਵੀ ਚਾਹੀਦਾ ਹੈ ਪੰਜਾਬੀ ਭਾਸ਼ਾ ਦੀ ਇਸ ਵਿੱਚ ਬਹੁਤ ਭੂਮਿਕਾ ਹੈ ਪੰਜਾਬ ਦੇ ਕਈ ਕਵੀਆਂ ਨੇ ਜਿਹਨਾਂ ਵਿੱਚੋਂ ਫਿਰੋਜ਼ਦੀਨ ਸਰਫ ਭਾਈ ਵੀਰ ਸਿੰਘ ਬੁੱਲੇ ਸ਼ਾਹ ਵਾਰਿਸ ਸ਼ਾਹ ਧਨੀ ਰਾਮ ਚਾਤਰਿਕ ਫਿਰ ਹੋਰ ਵੀ ਕਈ ਕਵੀ ਹੋਏ ਹਨ ਜਿਹਨਾਂ ਨੇ ਪੰਜਾਬੀਅਤ ਬਾਰੇ ਪੰਜਾਬੀ ਭਾਸ਼ਾ ਬਾਰੇ ਬੜਾ ਕੁਝ ਦੱਸਿਆ ਹੈ ਅਤੇ ਪੰਜਾਬੀ ਭਾਸ਼ਾ ਜਿਹੜੀ ਦੁਨੀਆਂ ਦੀਆਂ ਬਹੁਤ ਸਾਰੀਆਂ ਭਾਸ਼ਾ ਨਾਲੋਂ ਸ੍ਰੇਸ਼ਟ ਭਾਸ਼ਾ ਹੈ ਮਿੱਠੀ ਭਾਸ਼ਾ ਹੈ ਅਤੇ ਵਧੀਆ ਭਾਸ਼ਾ ਹੈ ਇਹ ਭਾ ਇਹ ਭਾਸ਼ਾ ਸੱਭਿਆਚਾਰਕ ਵਿਰਾਸਤ ਨੂੰ ਸੰਭਾਲਣ ਦੀ ਇੱਕ ਸਰਵੋਤਮ ਭਾਸਾ ਹੈ ਅਤੇ ਇਹਨੂੰ ਉਤਸਾਹਿਤ ਕਰਨ ਵਾਸਤੇ ਸੱਭਿਆਚਾਰ ਨੂੰ ਉਤਸਾਹਿਤ ਕਰਨ ਵਾਸਤੇ ਪੰਜਾਬੀ ਭਾਸ਼ਾ ਦਾ ਬੜਾ ਵੱਡਾ ਯੋਗਦਾਨ ਹੈ ਪੰਜਾਬੀ ਭਾਸ਼ਾ ਦੇ ਬਾਰੇ ਵਿੱਚ ਫਿਰੋਜ਼ਦੀਨ ਸਰਫ ਨੇ ਲਿਖਿਆ ਹੈ ਨੇ ਲਿਖਿਆ ਹੈ ਕਿ ਤੇਰੀ ਜੈ ਪੰਜਾਬੀ ਮਾਤਾ ਤੇਰੇ ਪੂਜਨ ਚਰਨ ਵਿਧਾਤਾ ਲੋਰੀਆਂ ਗਾ ਗਾ ਗੋਦ ਖਿਡਾਵੇ ਘੋੜੀਆਂ ਗਾ ਗਾ ਵਿਆਹ ਰਚਾਵੇ ਅਤੇ ਇਸ ਤਰ੍ਹਾਂ ਹੀ ਪੰਜਾਬੀ ਦੇ ਹੋਰ ਕਵੀਆਂ ਨੇ ਵੀ ਪੰਜਾਬੀ ਦੇ ਬਾਰੇ ਬੜਾ ਕੁਝ ਦੱਸਿਆ ਹੈ ਅਤੇ ਸੱਭਿਆਚਾਰ ਨੂੰ ਸੰਭਾਲਣ ਦੇ ਬਾਰੇ ਇਸ ਭਾਸ਼ਾ ਦਾ ਬਹੁਤ ਵੱਡਾ ਯੋਗਦਾਨ ਹੋ ਸਕਦਾ ਹੈ